ਹੈਲੋ ਹਾਂਜੀ ਹਾਂਜੀ ਦੱਸੋ ਮੈਮ ਹਾਂਜੀ ਮੈਮ ਦੱਸੋ ਜੀ ਠੀਕ ਮੈਮ ਐਡਰੈਸ ਹਾਂਜੀ ਹਾਂਜੀ ਮੈਮ ਆਪਣੇ ਕੋਲ ਡਟੋਲ ਹੈਗਾ ਇੰਥਾ ਤੇ ਹੋਰ ਵੀ ਬਹੁਤ ਸਾਰੇ ਹੈਗਾ ਪ੍ਰੋਡਕਟ ਤੁਹਾਨੂੰ ਕਿਹੜਾ ਚਾਹੀਦਾ ਠੀਕ ਮੈਮ ਪੂਰੀ ਪੈਕਿੰਗ ਦਾ ਹੋਵੇਗਾ ਜੀ ਤੁਹਾਡੇ ਲਈ ਪੰਦਰਾਂ ਹਜਾਰ ਮੈਮ ਉਹਦੇ ਵਿੱਚੋਂ ਤੁਹਾਡੇ ਲਈ ਮਤਲਬ ਇੱਕ ਡੱਬੇ ਵਿੱਚ ਚਾਲੀ ਪੀਸ ਨਿਕਲਣਗੇ

ਹਾਂਜੀ ਮੈਮ ਉਹਦੇ ਲਈ ਤੁਹਾਨੂੰ ਪੰਦਰਾਂ ਪ੍ਰਸੈਂਟ ਦੀ ਛੂਟ ਮਿਲੇਗੀ ਤੇ ਰੇਟ ਮੈਮ ਉਹਦੇ ਵਿੱਚੋਂ ਤੁਸੀਂ ਦੇ ਦਿਆ ਜੇ ਕੋਈ ਅਠਾਰਾਂ ਹਜਾਰ ਇਕੱਠਾ ਮੈਮ ਤੁਸੀਂ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਉਹਦੇ ਲਈ ਮੈਮ ਤੁਹਾਨੂੰ ਦਸ ਰੁਪਏ ਤੱਕ ਦਾ ਹੋ ਜਾਏਗਾ ਠੀਕ ਹੈ ਤੇ ਮੈਮ ਇਹ ਤੁਹਾਨੂੰ ਕਦੋਂ ਤੱਕ ਹਾਂਜੀ ਇਹ ਮੈਮ ਹੈਗਾ ਜੇ ਤੁਸੀਂ ਆਨਲਾਈਨ ਕਰੋਗੇ ਪੇ ਜਾਂ ਫਿਰ ਬਾਏ ਹੈਂਡ ਠੀਕ ਮੈਮ ਇਹ ਹੋ ਜਾਏਗਾ ਮੈਮ ਤੁਹਾਡਾ ਹਫਤੇ ਵਿੱਚ ਪਹੁੰਚਾ ਦਾਂਗੇ ਨਹੀਂ ਮੈਮ ਨਹੀਂ ਮੈਮ ਆਪਣਾ ਪ੍ਰੋਡਕਟ ਬਿਲਕੁਲ ਸਾਰਿਆਂ ਲਈ ਹੀ ਯੂਜਫੁਲ ਹੈ ਇਨੂੰ ਅਪ ਹਾਂਜੀ ਵੱਡੇ ਵੀ ਯੂਜ ਕਰ ਸਕਦੇ ਆ ਤੇ ਛੋਟੇ ਬੱਚੇ ਵੀ ਹਾਂਜੀ ਇਹਦੇ ਵਿੱਚ ਆਪਾਂ ਜਿਆਦਾ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਹੋਈ ਤੇ ਥੋਨੂੰ ਹਾਂਜੀ ਹਾਂਜੀ ਸਭ ਕੁਝ ਮਿਲਦਾ ਜੀ ਆਪਣੇ ਇਹ ਕਿੰਨੇ ਮੈਮ ਹੋਰ ਮੈਮ ਹੋਰ ਤਾਂ ਹੈਗੇ ਆ ਬਾਕੀ ਆਪਣੇ ਕੋਲ ਹਜੇ ਆਪਣਾ ਉਪਰੋਂ ਮਾਲ ਮੰਗਵਾਉਣਾ ਹੁੰਦਾ ਨਾ ਤੇ ਹੋਣਗੇ ਬਾਕੀ ਆਪਾਂ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਤੁਸੀਂ ਪਹਿਲਾਂ ਇਹਦਾ ਯੂਜ ਕਰਕੇ ਦੇਖਿਓ ਫਿਰ ਤੁਹਾਨੂੰ ਜੇ ਫਰਕ ਲੱਗੇ ਤਾਂ ਫਿਰ ਤੁਸੀਂ ਹੋਰ ਮੰਗਵਾ ਲਿਓ ਜੀ ਹਾਂਜੀ ਪੂਰੀ ਗਰੰਟੀ ਹੈ ਜੀ ਆਪਣੀ ਨਹੀਂ ਨਹੀਂ ਮੈਮ ਕੋਈ ਕੰਪਲੇਂਟ ਹੋਏ ਤੁਹਾਡੇ ਪੂਰੇ ਪੈਸੇ ਵਾਪਸ ਹਾਂਜੀ ਠੀਕ